ਤੁਹਾਡੀ ਰਾਏ ਵਿੱਚ ਪੇਂਡੂ ਭਾਈਚਾਰਿਆਂ ਵਿੱਚ ਖੇਤੀਬਾੜੀ ਉਦਯੋਗ ਵਿੱਚ ਸੁਧਾਰ ਲਈ ਕੀ ਕੀਤਾ ਜਾ ਸਕਦਾ ਹੈ ਪੇਂਡੂ ਪੇਂਡੂ ਦੇ ਵਿੱਚ ਖੇਤੀਬਾੜੀ ਦੇ ਵਿੱਚ ਸਾਨੂੰ ਪਹਿ ਪਹਿਲਾ ਰੇ ਰੇਹ ਪਾਉਣੀ ਚਾਹੀਦੀ ਦੇਸੀ ਰੇਹ ਹੁੰਦੀ ਹੈ ਪਿੰਡਾਂ ਦੇ ਵਿੱਚ ਰੇਹ ਦੇਸੀ ਰੇਹ ਤੋਂ ਬਾਅਦ ਅਸੀਂ ਉਹ ਤੋਂ ਵਧੀਆ ਬਿਜਾਈ ਹੋ ਜਾਂਦੀ ਆ ਅਤੇ ਉਹ ਫਿਰ ਅਸੀਂ ਮੱਕੀ ਬੀਜ ਸਕਦੇ ਹਾਂ ਮੱਕੀ ਮੱਕੀ ਤੋਂ ਬਾਅਦ ਹਰਹਰ ਸਰ੍ਹੋਂ ਸਰ੍ਹੋਂ ਹੋ ਜਾਂਦੀ ਆ ਅਤੇ ਓ ਅਤੇ ਕਣਕ ਕਣਕ ਬੀ ਬੀਜੀ ਜਾਂਦੀ ਆ ਉਹਦੇ ਵਿੱਚ ਅਤੇ ਸਾਨੂੰ ਸੁਧਾਰ ਵਾਸਤੇ ਸਾਨੂੰ ਨ ਵਧੀਆ ਐੱਮ ਐੱਸ ਟੀ ਸਾਨੂੰ ਫਸਲਾਂ ਉਹ ਲਾਉਣੀਆਂ ਚਾਹੀਦੀਆਂ ਹਨ ਅਤੇ ਪਾਣੀ ਦਾ ਵੀ ਸਾਨੂੰ ਬੱਚਤ ਹੋ ਹੋ ਜਾਂਦੀ ਆ ਉਸ ਕਰਕੇ ਪਾਣੀ ਦੀ ਬੱਚਤ ਕਰਕੇ ਸਾਨੂੰ ਅਤੇ ਆਪਣਾ ਅਤੇ ਨਵੇਂ ਤੋਂ ਨਵੀਆਂ ਖਾਦਾਂ ਜਿਹੜੀਆਂ ਹੁੰਦੀਆਂ ਆਪਣਾ ਦੇ ਦੇਸੀ ਖਾਦਾਂ ਜੀ ਹੋਣੀਆਂ ਚਾਹੀਦੀਆਂ ਹੈ ਅਤੇ ਮੂ ਮੂਲੀ ਬੀਜ ਲਉ ਮੂਲੀਆਂ ਵੀ ਠੀਕ ਆ ਸਿਆਲ ਦੇ ਵਿੱਚ ਖਾਣ ਨੂੰ ਨਾਲੇ ਸਲਾਦ ਠੀਕ ਹੁੰਦਾ ਹੈ ਅਤੇ ਸ਼ਲਗਮ ਹੋ ਗਈ ਅਤੇ ਸ਼ਲਗਮ ਦੇ ਬਾਅਦ 'ਚ ਆਪਣਾ ਉਹ ਲਾ ਲਉ ਸਾਗ ਸਰ੍ਹੋਂ ਸਰ੍ਹੋਂ ਦਾ ਸਾਗ ਹੁੰਦਾ ਸਰ੍ਹੋਂ ਦਾ ਸਾਗ ਵੀ ਨਾਲੇ ਮਿੱਟੀ ਉਪਜਾਊ ਹੋ ਜਾਂਦੀ ਆ ਅਤੇ ਨਾਲੇ ਪਾਣੀ ਵੀ ਬਹੁਤ ਘੱਟ ਲੱਗਦਾ ਇਹਨੂੰ ਅਤੇ ਖੇਤੀ ਦੇ ਵਿੱਚ ਸਾਨੂੰ ਬਹੁਤ ਨਵੀ ਨਵੀਆਂ ਤਕਨੀਕਾਂ ਕਾਰਨ ਸਾਨੂੰ ਆਪਣਾ ਰੇਹ ਦੇਸੀ ਰੇਹ ਦੀ ਵਰਤੋਂ ਕਰਕੇ ਸਾਨੂੰ ਅਤੇ ਇਹੀ ਵਰਤਣੀ ਚਾਹੀਦੀ ਹੈ ਅਤੇ ਆਪਣਾ